ਹਾਲ ਹੀ ਦੇ ਵਿੱਚ ਮੈਂ ਅਠਾਰਾਂ ਸਾਲ ਦੀ ਹੋਈ ਹਾਂ ਅਤੇ ਮੈਨੂੰ ਪੈਨ ਕਾਰਡ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਅੱਗੇ ਵਧਣ ਦੇ ਲਈ ਮੈਨੂੰ ਮੇਰੀ ਹਰ ਇੱਕ ਥਾਂ 'ਤੇ ਪੈਨ ਕਾਰਡ ਦੀ ਮੰਗ ਕੀਤੀ ਜਾਂਦੀ ਸੀ ਜਿਵੇਂ ਕਿ ਪਲਸ ਵਨ ਪਲਸ ਟੂ ਦੀ ਐਡਮਿਸ਼ਨ ਦੇ ਵਿੱਚ ਜਾਂ ਫਿਰ ਮੇਰੇ ਐਕਟੀਵਾ ਦਾ ਲਾਈਸੈਂਸ ਜਦੋਂ ਬਣਨਾ ਸੀ ਉਹਦੇ ਵਿੱਚ ਵੀ ਉਹਨਾਂ ਨੇ ਮੈਨੂੰ ਪੈਨ ਕਾਰਡ ਦੀ ਮੇਰੇ ਤੋਂ ਮੰਗ ਕੀਤੀ ਤਾਂ ਮੈਂ ਘਰ ਆਈ ਅਤੇ ਆਪਣੇ ਪਿਤਾ ਜੀ ਨਾਲ ਇਸ ਚੀਜ਼ ਦੇ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਮੈਨੂੰ ਪੈਨ ਕਾਰਡ ਦੀ ਜ਼ਰੂਰਤ ਹੈ

ਜਿਹਦੇ ਲਈ ਮੈਨੂੰ ਮੇਰਾ ਆਪਣਾ ਆਧਾਰ ਕਾਰਡ ਮੇਰਾ ਆਪਣਾ ਮੋਬਾਈਲ ਨੰਬਰ ਅਤੇ ਮੇਰੇ ਪਿਤਾ ਜੀ ਦਾ ਆਧਾਰ ਕਾਰਡ ਇਹ ਚੀਜ਼ਾਂ ਦੀ ਇਹ ਡਾਕੂਮੈਂਟਸ ਦੀ ਜ਼ਰੂਰਤ ਸੀ ਪੈਨ ਕਾਰਡ ਅਪਲਾਈ ਕਰਨ ਦੇ ਲਈ ਫਿਰ ਉਸ ਜਗ੍ਹਾ 'ਤੇ ਜਾ ਕੇ ਕੁਛ ਉਹਨਾਂ ਨੇ ਐਕਸਟਰਾ ਫੀਸ ਵੀ ਲਈ ਪੈਨ ਕਾਰਡ ਅਪਲਾਈ ਕਰਨ ਦੇ ਲਈ ਫਿਰ ਮੈਂ ਆਪਣੀ ਫੀਸ ਪੇ ਕਰਕੇ ਅਤੇ ਆਧਾਰ ਕਾਰਡ ਦੀਆਂ ਫੋਟੋਆਂ ਕਾਪੀਆਂ ਨਾਲ ਅਟੈਚ ਕਰਕੇ ਫਿਰ ਮੈਂ ਉਹਨਾਂ ਤੋਂ ਆਪਣਾ ਪੈਨ ਕਾਰਡ ਅਪਲਾਈ ਕਰਨ ਲਈ ਕਿਹਾ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਪੰਦਰਾਂ ਦਿਨ ਬਾਅਦ ਤੁਹਾਡਾ ਪੈਨ ਕਾਰਡ ਤੁਹਾਡੇ ਘਰ ਪਹੁੰਚ ਜਾਵੇਗਾ ਜਦੋਂ ਹੀ ਮੇਰਾ ਪੈਨ ਕਾਰਡ ਪੰਦਰਾਂ ਦਿਨ ਬਾਅਦ ਮੇਰੇ ਘਰ ਆਇਆ ਉਸ ਤੋਂ ਬਾਅਦ ਮੈਂ ਅੱਗੇ ਆਪਣੀ ਐਡਮਿਸ਼ਨ ਦਾ ਪ੍ਰੋਸੈਸ ਜਾਰੀ ਰੱਖਿਆ ਇਹਦੇ ਵਿੱਚ ਮੈਨੂੰ ਬਹੁਤ ਲਾਭ ਹੋਇਆ ਜਦੋਂ ਮੈਂ ਆਪਣਾ ਪੈਨ ਕਾਰਡ ਬਣਵਾਇਆ ਕਿਉਂਕਿ ਇਹ ਇੱਕ ਬਹੁਤ ਜ਼ਰੂਰੀ ਡਾਕੂਮੈਂਟ ਹੈ ਜੋ ਕਿ ਹਰ ਥਾਂ 'ਤੇ ਜ਼ਰੂਰੀ ਹੁੰਦਾ ਹੈ ਅਤੇ ਹਰ ਲੋਕ ਇਸ ਚੀਜ਼ ਦੀ ਮੰਗ ਕਰਦੇ ਹਨ ਕਿਉਂਕਿ ਇਹਦੇ ਉੱਤੇ ਆਪਣਾ ਪਰਮਾਨੈਂਟ ਐਡਰੈਸ ਲਿਖਿਆ ਹੁੰਦਾ ਹੈ ਜਿੱਥੇ ਆਪਾਂ ਰਹਿੰਦੇ ਹਾਂ ਇਹ ਬਹੁਤ ਜ਼ਰੂਰੀ ਹੈ